ਅੱਜ ਕੱਲ੍ਹ ਜਿਹੜੀ ਹੈ ਮਤਲਬ ਮੈਂ ਪੁਰਾਣੀ ਪੀੜੀ ਅਤੇ ਨੌਜਵਾਨ ਪੀੜੀ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਅੰਤਰ ਆ ਚੁੱਕੇ ਹੈ ਮੈਂ ਆਪਣੇ ਪਰਿਵਾਰ ਦੇ ਵਿੱਚ ਦੇਖ ਰਹੀ ਹਾਂ ਕਿ ਮੇਰੇ ਜਿਹੜੇ ਮਤਲਬ ਸਾਡੇ ਜਿਹੜੇ ਪੇਰੈਂਟਸ ਨੇ ਮਤ ਜਾਂ ਦਾਦਾ ਦਾਦੀ ਨੇ ਉਨ੍ਹਾਂ ਦੇ ਰਹਿਣ ਸਹਿਣ ਦਾ ਔਰ ਜਿਹੜੇ ਅੱਜ ਕੱਲ੍ਹ ਦੇ ਸਾਡੇ ਜਿਹੜੇ ਬੱਚੇ ਨੇ ਮੇਰੇ ਆਪਣੇ ਬੱਚੇ ਨੇ ਉਹਨਾਂ ਦੇ ਵਿੱਚ ਰਹਿਣ ਸਹਿਣ ਦੇ ਵਿੱਚ ਆਦਤਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਜਿਹੜੇ ਮੇਰੇ ਸਾਡੇ ਜਿਹੜੇ ਬਜ਼ੁਰਗ ਹੈਗੇ ਉਹ ਦੱਸਦੇ ਸੀ ਸਵੇਰੇ ਜਲਦੀ ਉੱਠਦੇ ਸੀਗੇ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਸੀਗੇ ਹੈ ਨਾ ਅਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਵੇਲੇ ਜਿਹੜਾ ਹੈ ਉਹ ਮਨੋਰੰਜਨ ਕਰਨ ਦੇ ਜਿਹੜੇ ਸਾਧਨ ਸੀਗੇ ਉਹ ਸੀਗੇ ਕਿ ਮਤਲਬ ਆਪਸ ਦੇ ਵਿੱਚ ਸੱਥ ਦੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਦੁੱਖ ਸੁੱਖ ਵਿਚਾਰਨੇ ਹੈ ਨਾ ਜਾਂ ਅਖਾੜੇ ਹੁੰਦੇ ਸੀਗੇ ਮੇਲੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਾਣਾ ਅਤੇ ਉੱਥੇ ਮਤਲਬ ਆਪਣਾ ਮਨੋਰੰਜਨ ਕਰਨਾ ਅਤੇ ਔਰਤਾਂ ਜਿਹੜੀਆਂ ਸੀ ਉਹ ਆਪਣਾ ਜਿਹੜਾ ਉਹ ਇਕੱਠੀਆਂ ਬਹਿ ਜਾਂਦੀਆਂ ਸੀ ਆਪਣਾ ਕੱਤ ਲੈਂਦੀਆਂ ਸੀਗੀਆਂ ਬੁਣਦੀਆਂ ਹੁੰਦੀਆਂ ਸੀਗੀਆਂ ਗੀਤ ਗਾ ਲੈਂਦੀਆਂ ਸੀ ਨੱਚ ਲੈਂਦੀਆਂ ਸੀ ਇਸ ਤਰ੍ਹਾਂ ਕਰਕੇ ਆਪਣਾ ਜਿਹੜਾ ਮਨੋਰੰਜਨ ਕਰ ਲੈਂਦੀਆਂ ਸੀ ਅਤੇ ਸਾਰਾ ਦਿਨ ਘਰ ਦੇ ਕੰਮ ਹੱਥੀਂ ਕਰਦੇ ਹੁੰਦੇ ਸੀ ਸਾਰੇ ਜਣੇ ਜਿਹੜੇ ਅਤੇ ਪਰ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਪੀੜੀ ਆ ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਤਲਬ ਅੰਤਰ ਆ ਚੁੱਕਾ ਹੈ ਔਰ ਅੱਜ ਕੱਲ੍ਹ ਦੀ ਜਿਹੜੀ ਪੀੜੀ ਆ ਉਹ ਮਤਲਬ ਪਹਿਲਾਂ ਤਾਂ ਪੜ੍ਹਾਈ ਦੇ ਵਿੱਚ ਹੀ ਬਹੁਤ ਜ਼ਿਆਦਾ ਮਤਲਬ ਬਿਜੀ ਹੋਈ ਪਈ ਹੈ ਦੂਸਰਾ ਜਿਹੜਾ ਹੈਗਾ ਹੈ ਫੋਨ ਜਿਹੜੇ ਆ ਅੱਜ ਕੱਲ੍ਹ ਆ ਚੁੱਕੇ ਹੈ ਫੋਨ ਦੇ ਆਉਣ ਦੇ ਕਾਰਨ ਤਾਂ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਵਿੱਚ ਬ ਮਤਲਬ ਅੰਤਰ ਆ ਚੁੱਕਾ ਹੈ ਇਹ ਇਹਨਾਂ ਦੀ ਸਾਂਝ ਹੀ ਟੁੱਟ ਛੁੱਟ ਗਈ ਹੋਈ ਹੈ ਇਸ ਹਰ ਵੇਲੇ ਜਿਹੜੇ ਫੋਨ ਦੇ ਵਿੱਚ ਲੱਗੇ ਰਹਿੰਦੇ ਹੈ ਮਤਲਬ ਇਹਨਾਂ ਨੇ ਕੋਈ ਵੀ ਗੱਲ ਕਰਨੀ ਹੁੰਦੀ ਹੈ ਫੋਨ ਦੇ ਥਰੂ ਉਹ ਜਿਹੜੇ ਮੈਸੇਜ ਮੈਸੇਜ ਕਰ ਦਿੰਦੇ ਮਤਲਬ ਅਸੀ ਅਸੀਂ ਆਪਸੀ ਜਿਹੜੀ ਬੋਲ ਚਾਲ ਆ ਸਾਡਾ ਜਿਹੜਾ ਇੰਟਰੈਕਸ਼ਨ ਜਿਹੜੀ ਹੈ ਉਹ ਲਗਭਗ ਖਤਮ ਹੋ ਗਈ ਹੈ ਮਤਲਬ ਅਸੀਂ ਕਿਸੇ ਨੂੰ ਸ਼ੁਭਕਾਮਨਾਵਾਂ ਦੇਣੀਆਂ ਅਸੀਂ ਮੈਸੇਜ ਥਰੂ ਦਿੰਦੇ ਅਸੀਂ ਬੋਲ ਕੇ ਨਹੀਂ ਦਿੰਦੇ ਹਾਂ ਸੋ ਅੱਜ ਕੱਲ੍ਹ ਉਹਨਾਂ ਰਿਸ਼ਤਿਆਂ ਦੀਆਂ ਜਿਹੜੀਆਂ ਉਹ ਜੋ ਮਤਲਬ ਅੱਗੇ ਰਿਸ਼ਤੇ ਜਿਹੜੇ ਆ ਉਹਨਾਂ ਨੂੰ ਅਸੀਂ ਰਿਸਪੈਕਟ ਦਿੰਦੇ ਸੀਗੇ ਮਾਣ ਸਤਿਕਾਰ ਦਿੰਦੇ ਸੀਗੇ ਉਹ ਅੱਜ ਕੱਲ੍ਹ ਜਿਹੜਾ ਘੱਟ ਗਿਆ ਹੈ ਮਤਲਬ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਪਹਿਲਾਂ ਤਾਂ ਹੁੰਦਾ ਸੀ ਅਤੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋ ਕੇ ਬੈਠ ਜਾਂਦਾ ਸੀ ਹੈ ਨਾ ਸਾਰੇ ਦੁੱਖ ਸੁੱਖ ਕਰਦੇ ਹੁੰਦੇ ਪਰ ਅੱਜ ਕੱਲ੍ਹ ਜਿਹੜੇ ਆ ਆਪੋ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਮਤਲਬ ਕੋਈ ਹੈ ਹੀ ਨਹੀਂ ਹੈ ਸੋ ਇਸ ਤਰ੍ਹਾਂ ਜਿਹੜਾ ਹੈ ਇਹਨਾਂ ਦੇ ਵਿੱਚ ਜਿਹੜਾ ਹੈ ਪੁਰਾਣੀ ਪੀੜੀ ਅਤੇ ਨਵੀਂ ਪੀੜੀ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਗਿਆ ਅਤੇ ਸਾਨੂੰ ਲੋੜ ਹੈ ਕਿ ਇਸ ਨੂੰ ਅਸੀਂ ਮਤਲਬ ਜਿਹੜਾ ਸੰਭਾਲੀਏ ਅਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮਤਲਬ ਅਨੁਭਵ ਕਰਦੀ ਹਾਂ